ਹਾਂਜੀ ਲੋਕ ਵਿਆਹ 'ਤੇ ਲੜਕੀ ਨੂੰ ਤੋਹਫੇ ਦਿੱਤੇ ਜਾਂਦੇ ਹਨ ਪਰ ਉਹ ਇੱਕ ਖੁਸ਼ੀ ਵਾਸਤੇ ਦਿੱਤੇ ਜਾਂਦੇ ਹਨ ਇੱਕ ਯਾਦਆਸ਼ਤ ਵਾਸਤੇ ਦਿੱਤੇ ਜਾਂਦੇ ਆ ਹਾਂਜੀ ਜਿਹਦੇ ਨਾਲ ਬੱਚੇ ਦੀ ਯਾਦਆਸ਼ਤ ਬਣੀ ਰਹਿੰਦੀ ਹੈ ਅਤੇ ਪਿਆਰ ਗਿਣਿਆ ਜਾਂਦਾ ਜਿਸ ਨੂੰ ਪਰ ਦਾਜ ਦੇਣਾ ਕੋਈ ਜ਼ਰੂਰੀ ਨਹੀਂ ਹੁੰਦਾ ਅਤੇ ਦੇਣਾ ਵੀ ਨਹੀਂ ਚਾਹੀਦਾ ਥੈਂਕ ਯੂ